ਭਾਰਤ ਵਿੱਚ ਜੇ ਆਵਾਜਾਈ ਪ੍ਰਣਾਲੀ ਦੀ ਗੱਲ ਕੀਤੀ ਜਾਵੇ ਤਾਂ ਉਹ ਭਾਰਤ ਕੋਲ ਹਰੇਕ ਆਵਾਜਾਈ ਦੇ ਸਾਧਨ ਹਨ ਜਿਵੇਂ ਆਪਾਂ ਹੈਲੀਕੋਪਟਰ ਐਰੋਪਲੇਨ ਜਾਂ ਟਰੇਨ ਜਾਂ ਆਪਾਂ ਬੱਸਾਂ ਕਹਿ ਸਕਦੇ ਹਨ ਪਰ ਇਹਨਾਂ ਦਾ ਕੋਈ ਟਾਈਮ ਪੱਕਾ ਨਹੀਂ ਆਪਾਂ ਕਹਿ ਸਕਦੇ ਜਿਸ ਕਰਕੇ ਸਾਨੂੰ ਜਦੋਂ ਯਾਤਰਾ ਕਰਦੇ ਹਾਂ ਤਾਂ ਸਾਨੂੰ ਬਹੁਤ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਿਉਂਕਿ ਜਦੋਂ ਕੋਈ ਯਾਤਰਾ ਕਰਨੀ ਹੈ ਕਿਸੇ ਟਾਈਮ ਮੌਸਮ ਖਰਾਬ ਹੋਣ ਕਰਕੇ ਕਿਸੇ ਸਹੀ ਟਾਈਮ 'ਤੇ ਅਸੀਂ ਉੱਥੇ ਪਹੁੰਚਣਾ ਹੁੰਦਾ ਅਤੇ ਉਹ ਉਹਨਾਂ ਸੁਵਿਧਾਵਾਂ ਦਾ ਦੀ ਵਰਤੋਂ ਕਰਕੇ ਆਪਾਂ ਉੱਥੇ ਟਾਇਮ ਸਿਰ ਨਹੀਂ ਪਹੁੰਚ ਸਕਦੇ ਜਾਂ ਕਿਤੇ ਮੰਨ ਲਉ ਕਿਸੇ ਆਪਾਂ ਨੂੰ ਜ਼ਰੂਰੀ ਜਾਣਾ ਪਵੇ ਅਤੇ ਉਹਦੇ ਲਈ ਵੀ ਜਿਹੜੀਆਂ ਆਵਾਜਾਈ ਦੇ ਸਾਧਨ ਨੇ ਹੈ ਤਾਂ ਕਹਿ ਸਕਦੇ ਵੀ ਭਾਰਤ ਵਿੱਚ ਬਹੁਤ ਨੇ ਪਰ ਟਾਈਮ 'ਤੇ ਕੋਈ ਵੀ ਚੀਜ਼ ਅਵੇਲੇਬਲ ਨਹੀਂ ਹੁੰਦੀ ਅਤੇ ਅਸੀਂ ਇਹ 'ਚ ਵਿੱਚ ਇਹ ਸੁਧਾਰ ਦੇਣਾ ਚਾਹਵਾਂਗੇ ਕਿ ਜੋ ਵੀ ਰੇਲਾਂ ਆਈਆਂ ਐਰੋਪਲੇਨ ਜਾਂ ਜੋ ਵੀ ਸਾਡੇ ਦੇਸ਼ ਵਿੱਚ ਬੱਸਾਂ ਚੱਲਦੀਆਂ ਹਨ ਉਹਨਾਂ ਦਾ ਰੂਟ ਜਿੱਦਾਂ ਬਾਹਰਲੇ ਦੇਸ਼ਾਂ ਵਿੱਚ ਪੱਕਾ ਹੁੰਦਾ ਵੀ ਇੰਨੇ ਟਾਈਮ 'ਤੇ ਆਹ ਚੀਜ਼ ਚੱਲਣੀ ਹੈ ਇਸੇ ਰੂਟ 'ਤੇ ਜਾਣੀ ਹੈ ਜਾਂ ਇਸ ਟਾਈਮ 'ਤੇ ਮਿਲਣੀ ਹੈ ਪੱਕਾ ਟਾਈਮ ਜੋ ਹੁੰਦਾ ਹੈ ਉਸੇ 'ਤੇ ਹੀ ਇਹ ਚੀਜ਼ਾਂ ਚੱਲਣੀਆਂ ਚਾਹੀਦੀਆਂ ਹਨ